ਧਰਮ ਲੋਕਾਂ ਨੂੰ ਇਕੱਠੇ ਕਰਦਾ ਹੈ ਕੋਈ ਵੀ ਤਿਉਹਾਰ ਮਨਾਉਣ ਲਈ ਉਹ ਕਿਸੇ ਵੀ ਸ ਸਿੱਖ ਧਰਮ ਦਾ ਹੋਵੇ ਚਾਹੇ ਉਹ ਮੁਸਲਿਮ ਧਰਮ ਦਾ ਹੋਵੇ ਕੋਈ ਵੀ ਤਿਉਹਾਰ ਹੋਵੇ ਸਾਰੇ ਲੋਕ ਉਸਨੂੰ ਮਿਲ ਕੇ ਇਕੱਠੇ ਮਨਾਉਂਦੇ ਹਨ ਧਰਮ ਵਿੱਚ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਸਾਰੇ ਵਿਅਕਤੀਆਂ ਨੂੰ ਕੋਈ ਵੀ ਤਿਉਹਾਰ ਮਨਾਉਣ ਦਾ ਅਧਿਕਾਰ ਹੁੰਦਾ ਹੈ ਬੇਸ਼ੱਕ ਉਹ ਕਿਸੇ ਵੀ ਜਾਤ ਦਾ ਹੋਵੇ ਚਾਹੇ ਉਹ ਉਸ ਧਰਮ ਨੂੰ ਮੰਨਦਾ ਹੋਵੇ ਚਾਹੇ ਉਹ ਉਸ ਧਰਮ ਨੂੰ ਨਾ ਮੰਨਦਾ ਹੋਵੇ ਤਿਉਹਾਰ 'ਤੇ ਲੋਕੀ ਬਹੁਤ ਸਾਰੇ ਮੇਲੇ ਲਗਵਾਉਂਦੇ ਹਨ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮੇਲਾ ਲਗਵਾਇਆ ਜਾਂਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਗੁਰਪੁਰਬ ਮਨਾਇਆ ਜਾਂਦਾ ਹੈ ਪਿੰਡਾਂ ਵਿੱਚ ਨਗਰ ਕੀਰਤਨ ਕੀਤਾ ਜਾਂਦਾ ਹੈ ਨਗਰ ਕੀਰਤਨ 'ਤੇ ਲੋਕ ਵੱਖ ਵੱਖ ਲੰਗਰ ਲਗਾਉਂਦੇ ਹਨ ਅਤੇ ਹਰ ਇੱਕ ਧਰਮ ਦੇ ਵਿਅਕਤੀ ਉੱਥੇ ਲੰਗਰ ਲਗਾਉਂਦੇ ਹਨ ਇਸ ਤਰ੍ਹਾਂ ਸਾਰੇ ਵਿਅਕਤੀਆਂ ਨੂੰ ਧਰਮ ਨਾਲ ਜੋੜਿਆ ਜਾਂਦਾ ਹੈ ਧਰਮ ਵਿੱਚ ਕਿਸੇ ਵੀ ਵਿਅਕਤੀ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਗੁਰਦੁਆਰਾ ਸਾਹਿਬ ਵਿੱਚ ਲੰਗਰ ਲਗਾਏ ਜਾਂਦੇ ਹਨ ਇਸ ਤਰ੍ਹਾਂ ਹਰ ਇੱਕ ਧਰਮ ਦੇ ਵਿਅਕਤੀ ਨੂੰ ਉੱਥੇ ਲੰਗਰ ਛਕਣ ਦੀ ਆਗਿਆ ਦਿੱਤੀ ਜਾਂਦੀ ਹੈ ਵੱਖ ਵੱਖ ਧਰਮਾਂ ਜਾਤਾਂ ਦੇ ਲੋਕ ਆਉਂਦੇ ਹਨ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਂਦੇ ਹਨ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਧਰਮ ਬਹੁਤ ਸਾਰੇ ਹੁੰਦੇ ਹਨ ਜਿਵੇਂ ਮੁਸਲਿਮ ਧਰਮ ਹਿੰਦੂ ਧਰਮ ਅਤੇ ਤਿਹਾ ਤਿਉਹਾਰ ਹਰ ਇੱਕ ਵਿਅਕਤੀ ਦਾ ਸਾਂਝਾ ਹੁੰਦਾ ਹੈ ਹਰ ਇੱਕ ਵਿਅਕਤੀ ਤਿਉਹਾਰ ਮਨਾ ਸਕਦਾ ਹੈ ਬੇਸ਼ੱਕ ਉਹ ਕਿਸੇ ਵੀ ਧਰਮ ਦਾ ਹੋਵੇ ਵਿਅਕਤੀ ਤਿਉਹਾਰ ਮਨਾਉਂਦੇ ਹਨ